ਔਨਲਾਈਨ ਕੋਚਿੰਗ ਸ਼ੁਰੂ ਹੋਈ ਜਦੋਂ ਕਰੋਨਾ ਆਇਆ ਉਸ ਵੇਲੇ ਤਾਂ ਇਹ ਫਾਇਦੇਮੰਦ ਸੀ ਕਿਉਂਕਿ ਬੱਚੇ ਸਕੂਲ ਨਹੀਂ ਜਾਂਦੇ ਸਨ ਉਹਨਾਂ ਨੂੰ ਘਰ ਹੀ ਘਰ ਸਕੂਲਾਂ ਸਕੂਲਾਂ ਦੇ ਟੀਚਰ ਆਪਣੇ ਲੈਕਚਰ ਦੇ ਕੇ ਪੜ੍ਹਾ ਦਿੰਦੇ ਸਨ ਅ ਤੇ ਬੱਚੇ ਥੋੜ੍ਹਾ ਬਹੁਤ ਕੰਮ ਕਰ ਲੈਂਦੇ ਸਨ ਪਰ ਕਰੋਨਾ ਕਾਲ ਤੋਂ ਬਾਅਦ ਵੀ ਇਹ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਇਸ ਦਾ ਫਾਇਦਾ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਨੁਕਸਾਨ ਜ਼ਿਆਦਾ ਨਜ਼ਰ ਆਉਂਦੇ ਨੇ ਕਿਉਂਕਿ ਬੱਚੇ ਜਦੋਂ ਮੋਬਾਇਲ ਫੜ ਲੈਂਦੇ ਆ ਤਾਂ ਉਹ ਪੜ੍ਹਾਈ ਵੱਲ ਧਿਆਨ ਘੱਟ ਦਿੰਦੇ ਆ ਜ਼ਿਆਦਾਤਰ ਉਹ ਗੇਮਜ਼ ਮੋਬਾਈਲ ਖੋਲ੍ਹ ਕੇ ਅਤੇ ਗੇਮਜ਼ ਖੇਡਦੇ ਰਹਿੰਦੇ ਆ ਪਲੱਸ ਜੋ ਉਹਨਾਂ ਨੂੰ ਪੜ੍ਹਾਇਆ ਜਾਂਦਾ ਵਾ ਬੱਚੇ ਉਸ ਨੂੰ ਸੁਣਦੇ ਨਹੀਂ ਧਿਆਨ ਨਾਲ ਨਹੀਂ ਸੁਣਦੇ ਅਤੇ ਸੁਣੀ ਹੋਈ ਗੱਲ ਕਈ ਵਾਰੀ ਭੁੱਲ ਜਾਂਦੀ ਹੈ ਅਤੇ ਦੁਬਾਰਾ ਦੁਬਾਰਾ ਬੱਚੇ ਇਹ ਨਹੀਂ ਉਠਾਉਂਦੇ ਕਿ ਅਸੀਂ ਦੁਬਾਰਾ ਉਸਨੂੰ ਵੇਖ ਲਈਏ ਪੜ੍ਹ ਲਈਏ ਜੇ ਉਹਨਾਂ ਨੇ ਦੁਬਾਰਾ ਹੀ ਦੇਖਣਾ ਹੈ ਤਾਂ ਉਹ ਪਹਿਲੋਂ ਕਿਉਂ ਨਾ ਧਿਆਨ ਨਾਲ ਦੇਖਣ ਉਹ ਜ਼ਿਆਦਾਤਰ ਗੇਮਜ਼ ਵਿੱਚ ਹੀ ਟਾਈਮ ਵੇਸਟ ਕਰਦੇ ਆ ਇਸ ਕਰਕੇ ਜਦੋਂ ਅਸੀਂ ਟੀਚਰ ਕੋਲੋਂ ਸੁਣ ਕੇ ਜਾਂ ਲਿਖ ਕੇ ਕੋਈ ਵੀ ਲੈਸਨ ਕਰਦੇ ਹਾਂ ਯਾਦ ਕਰਦੇ ਹਾਂ ਉਹ ਸਾਨੂੰ ਸਾਡੇ ਦਿਮਾਗ 'ਤੇ ਕਾਫੀ ਚੰਗਾ ਅਸਰ ਪਾਉਂਦਾ ਹੈ ਔਰ ਲਿਖਿਆ ਹੋਇਆ ਵੈਸੇ ਵੀ ਇਹ ਤੇ ਪੱਕੇ ਤੌਰ 'ਤੇ ਯਾਦ ਹੋ ਜਾਂਦਾ ਹੈ ਹੋਰ ਦੂਸਰੀ ਗੱਲ ਇਹ ਹੈ ਕਿ ਮੋਬਾਈਲ ਦੇ ਉੱਤੇ ਜਦੋਂ ਅਸੀਂ ਪੜ੍ਹਦੇ ਔਨਲਾਈਨ ਕੋਚਿੰਗ ਬੱਚੇ ਲੈਂਦੇ ਆ ਤਾਂ ਮੋਬਾਇਲ ਦੇ ਉੱਤੇ ਅੱਖਾਂ ਟਿੱਕੀਆਂ ਰਹਿੰਦੀਆਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਅਸਰ ਬਹੁਤ ਪੈਂਦਾ ਹੈ ਅਤੇ ਉਹਨਾਂ ਦੇ ਦਿਮਾਗੀ ਡਿਵੈਲਪਮੈਂਟ ਵੀ ਘੱਟ ਹੁੰਦੀ ਹੈ ਇਸ ਕਰਕੇ ਸਾਨੂੰ ਮੈਨੂੰ ਤਾਂ ਇਹਦੇ ਵਿੱਚ ਔਨਲਾਈਨ ਸਕੂਲਿੰਗ ਜਾਂ ਕੋਚਿੰਗ ਦਾ ਫਾਇਦਾ ਬਹੁਤ ਘੱਟ ਨਜ਼ਰ ਆ ਰਿਹਾ ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਔਨਲਾਈਨ ਕੋਚਿੰਗ ਹੋਵੇ ਆਹਮੋ ਸਾਹਮਣੇ ਬੱਚੇ ਔਰ ਅਧਿਆਪਕ ਪੜ੍ਹਾਉਣ ਲਿਖਣ ਤਾਂ ਉਹਦਾ ਜ਼ਿਆਦਾ ਫਾਇਦਾ ਹੋਵੇਗਾ ਧੰਨਵਾਦ